ਸਾਡੇ ਫਤਿਹਗੜ੍ਹ ਜ਼ਿਲ੍ਹੇ ਵਿੱਚ ਸਿੰਚਾਈ ਦੀਆਂ ਬਹੁਤ ਵਧੀਆ ਸਹੂਲਤਾਂ ਹਨ ਜਿਵੇਂ ਕੀ ਪਾਣੀ ਟਿਊਬਲ ਅਤੇ ਪਾਣੀ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਜੀ ਜਿਵੇਂ ਚੌਵੀ ਘੰਟੇ ਦੀ ਬਿਜਲੀ ਦਿੱਤੀ ਵੀ ਹੈ ਸਰਕਾਰ ਨੇ ਬਹੁਤ ਵਧੀਆ ਸਹੂਲਤਾਂ ਕਰਤੀਆਂ ਜੀ ਜਿਵੇਂ ਸੂਏ ਨਹਿਰਾਂ ਜੀ ਇਹਨਾਂ 'ਚੋਂ ਵੀ ਜਿਵੇਂ ਲੋੜ ਹੁੰਦੀ ਹੈ ਪਾਣੀ ਵਰਤ ਲੈਂਦੇ ਹਾਂ ਜੀ ਪੈਪ ਪਾਏ ਵੇ ਆ ਜੀ ਥੱਲੇ ਨੂੰ ਪਾਣੀ ਦੇ ਅਤੇ ਜਿਹੜੀਆਂ ਮੇਨ ਫਸਲਾਂ ਸਾਰੀਆਂ ਬੀਜੀਆਂ ਜਿਹਨਾਂ ਨੂੰ ਟੈਮ ਸਿਰ ਪਾਣੀ ਦਿੱ ਪਾਣੀ ਦਿੱਤਾ ਜਾਂਦਾ ਚੌਵੀ ਘੰਟੇ ਦੀ ਲੈਟ ਹੈ ਜੀ ਉਰੇ ਮੋਟਰਾਂ ਨੂੰ ਜਾ ਲੋੜ ਹੁੰਦੀ ਆ ਫਸਲ ਨੂੰ ਪਾਣੀ ਦੀ ਪਾਣੀ ਦੇ ਦਿੰਦੇ ਹਾਂ ਜੀ ਜਿਵੇਂ ਸੂਰਜਮੁਖੀ ਹੋ ਗਈ ਜੀ ਜਿਵੇਂ ਇੱਖ ਹੋ ਗਿਆ ਜੀ ਜਿਵੇਂ ਕਣਕ ਹੋ ਗਈ ਜੀ ਇਹ ਸਾਰੀਆਂ ਫਸਲਾਂ ਨੂੰ ਅਸੀਂ ਟਾਇਮ ਨਾਲ ਪਾਣੀ ਬਰਸੀਨ ਹੋ ਗਿਆ ਜੀ ਵੀ ਵਧੀਆ ਤਰੀਕੇ ਨਾਲ ਸਹੂਲਤ ਬਹੁਤ ਵਧੀਆ ਪੰਜਾਬ ਨੂੰ ਦਿੱਤੀ ਵੀ ਹੈ ਜੀ ਇਹ